ਹੈਲੋ ਸਤਿ ਸ਼੍ਰੀ ਅਕਾਲ ਤੁਸੀਂ ਕੌਣ ਬੋਲਦੇ ਜੀ ਅੱਛਾ ਜੀ ਠੀਕ ਹੈ ਜੀ ਮੈਂ ਤੁਹਾਡੀ ਕੀ ਮਦਦ ਕਰ ਸਕਦੀ ਹਾਂ ਅੱਛਾ ਜੀ ਠੀਕ ਹੈ ਜੀ

ਠੀਕ ਆ ਅਤੇ ਤੁਸੀਂ ਉੱਥੋਂ ਬਾਏ ਵੀ ਕਰ ਸਕਦੇ ਓਂ ਖਰੀਦ ਵੀ ਸਕਦੇ ਓਂ ਅਤੇ ਤੁਸੀਂ ਆਪਣੇ ਹਿਸਾਬ ਨਾਲ ਵੀ ਤਿਆਰ ਕਰਾ ਸਕਦੇ ਓਂ ਉੱਥੋ ਫੁਲਕਾਰੀ ਫੁਲਕਾਲੀ ਤੁਸੀਂ ਦੋ ਹਜ਼ਾਰ ਤੋਂ ਲੈ ਕੇ ਦਸ ਹਜ਼ਾਰ ਪੰਦਰਾਂ ਹਜ਼ਾਰ ਤੱਕ ਵੀ ਜਿਸ ਹਿਸਾਬ ਨਾਲ ਤੁਸੀਂ ਖਰੀਦਣੀ ਚਾਹੋਂਗੇ ਅਤੇ ਦੋ ਹਜ਼ਾਰ ਤੋਂ ਰੇਂਜ ਸਟਾਰਟ ਆ ਗੀ ਹਲਕੀ ਫੁਲਕਾਰੀ ਤੁਹਾਨੂੰ ਦੋ ਹਜ਼ਾਰ ਦੇ ਵਿੱਚ ਮਿਲ ਜੇਗੀ

ਹਾਂਜੀ ਹਾਂਜੀ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਤੁਹਾਨੂੰ ਉੱਥੋਂ ਮਿਲ ਜਾਣੀਆਂ ਅਤੇ ਇੱਕ ਦਾਤਾ ਵਾਲਿਆਂ ਦੀ ਸ਼ੋਪ ਆ ਉੱਥੇ ਅਦਾਲਤ ਮਾਰਕੀਟ ਦੇ ਵਿੱਚ ਤੁਸੀਂ ਉੱਥੇ ਦੀ ਵਿਜਿਟ ਕਰ ਸਕਦੇ ਓਂ ਅਤੇ ਇਸ ਤੋਂ ਬਿਨਾਂ ਜੇ ਤੁਸੀਂ ਅੰਮ੍ਰਿਤਸਰ ਵੀ ਜਾ ਸਕਦੇ ਓਂ ਹਾਂਜੀ ਅੰਮ੍ਰਿਤਸਰ ਦੇ ਵਿੱਚ ਮੇਨ ਗੁਰਦੁਆਰਾ ਸਾਹਿਬ ਨੇ ਹਰਮੰਦਿਰ ਸਾਹਿਬ ਉਹਦੇ ਵਿੱਚ ਜਿਹੜੀ ਮੇਨ ਗਲੀ ਆ ਉਹਦੇ ਵਿੱਚ ਹੀ ਤੁਹਾਨੂੰ ਬਾਏ ਕਰ ਸਕਦੇ ਹੋ ਠੀਕ ਹੈ ਜੀ ਥੈਂਕ ਯੂ ਓਕੇ ਜੀ ਓਕੇ ਓਕੇ ਓਕੇ